ਪੰਜਾਬ ਦੀਆਂ ਰਵਾਇਤੀ ਖੇਡਾਂ ਕਈ ਹਨ ਜਿਵੇਂ ਕਿ ਕੋਟਲਾ ਛਪਾਕੀ ਖੋ ਖੋ ਬਾਂਦਰ ਕਿੱਲਾ ਕਬੱਡੀ ਇਹ ਸਾਰੀਆਂ ਹੀ ਖੇਡਾਂ ਬਹੁਤ ਦਿਲਚਸਪ ਹਨ ਅਤੇ ਇਨ੍ਹਾਂ ਨੂੰ ਖੇਡਣ ਦੇ ਤਰੀਕੇ ਉਸ ਤੋਂ ਵੀ ਵੱਧ ਦਿਲਚਸਪ ਹਨ ਜਿਵੇਂ ਕਿ ਬਾਂਦਰ ਕਿੱਲਾ ਇਹਦੇ ਵਿੱਚ ਇੱਕ ਬੱਚਾ ਵਾਰੀ ਦਿੰਦਾ ਹੈ ਉਹਦੇ ਨਾਲ ਠੀਕਰੀਆਂ ਇੱਕ ਤੋਂ ਉੱਪਰ ਇੱਕ ਲਗਾ ਕੇ ਇੱਕ ਲੇਅਰ ਬਣਾ ਦਿੰਦਾ ਹੈ ਬਾਕੀ ਬੱਚੇ ਜਿਹੜੇ ਕਿ ਕੱਪੜੇ ਦੀ ਇੱਕ ਬਾਲ ਬਣਾ ਲੈਂਦੇ ਹਨ ਉਨ੍ਹਾਂ ਦੇ ਨਾਲ ਉਹ ਉਸਨੂੰ ਭੰਨਣ ਦੀ ਕੋਸ਼ਿਸ਼ ਕਰਦੇ ਹਨ ਜਿਵੇਂ ਹੀ ਉਹ ਠੀਕਰੀਆਂ ਵਾਲੀ ਜਿਹੜੀ ਲੇਅਰ ਹੈ ਉਹ ਟੁੱਟ ਜਾਂਦੀ ਹੈ ਤਾਂ ਬੱਚ ਜਿਹੜਾ ਬੱਚਾ ਬਾਂਦਰ ਦੇ ਰੂਪ ਦੇ ਵਿੱਚ ਉਸ ਦੀ ਰਾਖੀ ਕਰ ਰਿਹਾ ਸੀ ਉਹ ਉਨ੍ਹਾਂ ਦੇ ਪਿੱਛੇ ਦੌੜਦਾ ਹੈ ਜਿਸ ਵੀ ਬੱਚੇ ਨੂੰ ਉਹ ਹੱਥ ਲਾ ਦਿੰਦਾ ਹੈ ਉਹ ਬੱਚਾ ਫੇਰ ਬਾਂਦਰ ਦੀ ਵਾਰੀ ਮਤਲਬ ਕਿ ਉਸ ਦੀ ਵਾਰੀ ਆ ਜਾਂਦੀ ਹੈ ਐਵੇਂ ਹੀ ਇਹ ਜਿਹੜੀ ਫੇਰ ਦੁਬਾਰਾ ਠੀਕਰੀਆਂ ਦੀ ਲੇਅਰ ਤਿਆਰ ਕੀਤੀ ਜਾਂਦੀ ਹੈ ਅਤੇ ਜਿਸ ਬੱਚੇ ਦੀ ਵਾਰੀ ਆਉਂਦੀ ਹੈ ਉਹ ਉਸ ਦੀ ਬਾਂਦਰ ਬਣ ਕੇ ਵਾਰੀ ਦਿੰਦਾ ਹੈ ਅਤੇ ਇਵੇਂ ਹੀ ਐਵੇਂ ਇਹ ਗੇਮ ਅੱਗੇ ਤੋਂ ਅੱਗੇ ਚਲਦੀ ਰਹਿੰਦੀ ਹੈ